ਮੇਰਾ ਨਾਂ ਰਾਘਵ ਹੈ ਮੈਂ ਪਠਾਨਕੋਟ ਸ਼ਹਿਰ ਦਾ ਰਹਿਣ ਵਾਲਾ ਹਾਂ ਜੇਕਰ ਗੱਲ ਕਰੀਏ ਕਿ ਭੰਗੜੇ ਵਿੱਚ ਕਿਸ ਤਰ੍ਹਾਂ ਦੇ ਕੱਪੜੇ ਪਾਏ ਜਾਂਦੇ ਹਨ ਤਾਂ ਭੰਗੜੇ ਵਿੱਚ ਕੁੜਤਾ ਪਜਾਮਾ ਅਤੇ ਪੱਗ ਬੰਨ੍ਹੀ ਜਾਂਦੀ ਹੈ ਜਿਸ ਨਾਲ ਭੰਗੜਾ ਬਹੁਤ ਵਧੀਆ ਲੱਗਦਾ ਹੈ ਭੰਗੜਾ ਅਸੀਂ ਪੈਂਟ ਕਮੀਜ਼ 'ਚ ਨਹੀਂ ਕਰ ਸਕਦੇ ਕਿਉਂਕਿ ਪੈਂਟ ਕਮੀਜ਼ ਬਹੁਤ ਤੰਗ ਹੋ ਜਾਂਦੀ ਹੈ ਅਤੇ ਉਸ ਵਿੱਚ ਭੰਗੜਾ ਨਹੀਂ ਕੀਤਾ ਜਾ ਸਕਦਾ ਭੰਗੜੇ ਵਿੱਚ ਅਸੀਂ ਕਈ ਤਰ੍ਹਾਂ ਦੇ ਯੰਤ ਚੀਜ਼ਾਂ ਨਾਲ ਭੰਗੜਾ ਪਾਉਂਦੇ ਹਾਂ ਜਿਵੇਂ ਡੰਡਿਆਂ ਨਾਲ ਆਦਿ ਨਾਲ ਫਿਰ ਭੰਗੜਾ ਸਾਡੇ ਪੰਜਾਬ ਦਾ ਬਹੁਤ ਪ੍ਰਸਿੱਧ ਨਾਚ ਹੈ ਮੈਂ ਵੀ ਭੰਗੜਾ ਪਾਉਂਦਾ ਹਾਂ ਮੈਨੂੰ ਬਹੁਤ ਭੰਗੜਾ ਬਹੁਤ ਪਸੰਦ ਹੈ ਜੇਕਰ ਗੱਲ ਕਰੀਏ ਕਿ ਭੰਗੜੇ ਵਿੱਚ ਸਰੀਰ ਦਾ ਬਹੁਤ ਜ਼ੋਰ ਲੱਗਦਾ ਹੈ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ ਭੰਗੜਾ ਸਾਡੇ ਸਕੂਲਾਂ ਕਾਲਜਾਂ ਵਿੱਚ ਕਈ ਜਗ੍ਹਾ ਪਾਇਆ ਜਾਂਦਾ ਹੈ ਸਾਡੇ ਕੋ ਸਕੂਲਾਂ ਕਾਲਜਾਂ ਦੇ ਕਈ ਫੰਕਸ਼ਨਾਂ ਵਿੱਚ ਭੰਗੜਾ ਨਾਚ ਕੀਤਾ ਜਾਂਦਾ ਹੈ ਇਹ ਭੰਗੜਾ ਮੁੰਡੇ ਕੁੜੀਆਂ ਇਕੱਠੇ ਪਾ ਸਕਦੇ ਹਨ ਭੰਗੜਾ ਅੱਜ ਕੱਲ ਬਾਹਰਲੇ ਦੇਸ਼ਾਂ 'ਚ ਵੀ ਬਹੁਤ ਮਸ਼ਹੂਰ ਹੈ ਬਾਹਰਲੇ ਦੇਸ਼ ਦੇ ਲੋਕ ਖਾਸ ਪ ਪੰਜਾਬ ਦੇ ਲੋਕਾਂ ਨੂੰ ਭੰਗੜੇ ਵਾਸਤੇ ਬੁਲਾਉਂਦੇ ਹਨ ਭੰਗੜਾ ਸਾਡੇ ਪੰਜਾਬ ਦਾ ਬਹੁਤ ਪ੍ਰਸਿੱਧ ਨਾਚ ਹੈ ਇਹ ਮੈਂ ਤਾਂ ਇਹੀ ਕਹਾਂਗਾ ਕਿ ਸਾਨੂੰ ਸਕੂਲਾਂ ਕਾਲਜਾਂ 'ਚ ਜਿੰਨੇ ਵੀ ਫੰਕਸ਼ਨ ਹੁੰਦੇ ਹਨ ਸਭ ਤੋਂ ਪਹਿਲਾਂ ਭੰਗੜਾ ਹੀ ਕਰਵਾਇਆ ਜਾਂਦਾ ਹੈ ਸਾਡੇ ਪੰਜਾਬ 'ਚ ਕਈ ਭੰਗੜੇ ਦੇ ਕਈ ਕੋਂਪਟੀਸ਼ਨ ਹੁੰਦੇ ਹਨ ਜਿਨ੍ਹਾਂ ਵਿੱਚ ਮੁੰਡੇ ਕੁੜੀਆਂ ਭਾਗ ਲੈਂਦੇ ਹਨ